ਪੰਜਾਬ ਦੇ ਸਾਹਮਣੇ ਵਪਾਰਕ ਚੁਣੌਤੀਆਂ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ ਸਭ ਤੋਂ ਪਹਿਲਾਂ ਆਯੋਜਿਤ ਖੇਤਰ ਤੋਂ ਮੁਕਾਬਲਾ ਵੱਡੀ ਸਮੱਸਿਆ ਹੈ ਕਿਉਂਕਿ ਛੋਟੇ ਅਤੇ ਬਿਨਾਂ ਰਜਿਸਟਰੀ ਹੋਏ ਵਪਾਰ ਨਿਯਮਾਂ ਤੋਂ ਬਚ ਕੇ ਕੰਮ ਕਰਦੇ ਹਨ ਜਿਸ ਕਾਰਨ ਆਯੋਜਿਤ ਉਦਯੋਗਾਂ ਨੂੰ ਮੁਕਾਬਲੇ ਦੀ ਤਕਲੀਫ ਹੁੰਦੀ ਹੈ ਦੂਜੀ ਬੜੀ ਚੁਣੌਤੀ ਸਰਹੱਦੀ ਵਪਾਰ ਹੈ ਕਿਉਂਕਿ ਵ ਪੰਜਾਬ ਦੀ ਭਾਰਤ ਪਾਕਿਸਤਾਨ ਸਰਹੱਦ ਹੋਣ ਕਰਕੇ ਵਪਾਰ ਅਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਵਾਰ ਵਾਰ ਹੌਲੀ ਵਪਾਰ ਨੀਤੀ ਸਿਆਸੀ ਤਨਾਅ ਅਤੇ ਸੁਰੱਖਿਆ ਸੰਬੰਧੀ ਚੁਣੌਤੀਆਂ ਕਾਰਨ ਵਪਾਰਿਕ ਸਰਗਰਮੀਆਂ ਪ੍ਰਭਾਵਿਤ ਹੁੰਦੀਆਂ ਹਨ ਤੀਜੀ ਮਹੱਤਵਪੂਰਨ ਸਮੱਸਿਆ ਨਿਯਮ ਅਤੇ ਪਾਬੰਦੀਆਂ ਨਾਲ ਜੁੜੀ ਹੋਈ ਹੈ ਕਿਉਂਕਿ ਵਪਾਰ ਅਤੇ ਉਦਯੋਗਾਂ ਨੂੰ ਸਰਕਾਰੀ ਨਿਯਮ ਟੈਕਸ ਅਤੇ ਲਾਇਸੈਂਸ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੋ ਕਿ ਬਹੁਤ ਵਾਰ ਥਕਾਵਟੀ ਅਤੇ ਸਮਾਂ ਲੈਣ ਵਾਲੀ ਹੋ ਸਕਦੀ ਹੈ ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਦੀ ਘਾਟ ਜਿਵੇਂ ਕਿ ਬਿਜਲੀ ਟ੍ਰਾਂਸਪੋਟ ਅਤੇ ਆਧੁਨਿਕ ਤਕਨੀਕ ਦੀ ਕਮੀ ਵੀ ਵਪਾਰਕ ਵਿਕਾਸ ਨੂੰ ਖੱਪ ਪਾਉਂਦੀ ਹੈ ਨਤੀਜੇ ਵਜੋਂ ਪੰਜਾਬ ਵਿੱਚ ਵਪਾਰ ਨੂੰ ਸਥਿਰ ਅਤੇ ਤੇਜ਼ੀ ਨਾਲ ਵਿਕਸਿਤ ਕਰਨ ਲਈ ਇਨ੍ਹਾਂ ਚੁਣੌਤੀਆਂ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੈ